ਮੈਨੂੰ ਨਾ ਪੇਂਟਿੰਗ ਕਰਨ ਦਾ ਬਹੁਤ ਸ਼ੌਕ ਆ ਅਤੇ ਮੈਂ ਇੱਕ ਪਹਾੜਾਂ ਦੀ ਪੇਂਟਿੰਗ ਬਣਾਈ ਆ ਜੋ ਕਿ ਨਦੀ ਦੇ ਕਿਨਾਰੇ ਬਣਾਈ ਹੈ ਅਤੇ ਉਹ ਪੇਂਟਿੰਗ ਦੇ ਵਿੱਚ ਜੇ ਮੈਨੂੰ ਕਦੀ ਵੀ ਜਾਣ ਦਾ ਮੌਕਾ ਮਿਲੇ ਤਾਂ ਮੈਂ ਉੱਥੇ ਜਾ ਕੇ ਇੱਕ ਛੋਟਾ ਜਿਹਾ ਆਪਣਾ ਘਰ ਬਣਾਉਗੀ ਅਤੇ ਆਲੇ ਦੁਆਲੇ ਸਬਜ਼ੀਆਂ ਵਗੈਰਾ ਉਗਾਉਂਗੀ ਅਤੇ ਹਰਿਆਲੀ ਵਗੈਰਾ ਵੈਸੇ ਵੀ ਮੈਨੂੰ ਬਹੁਤ ਪਸੰਦ ਆ ਅਤੇ ਨਾਲ ਮੈਂ ਮੱਝਾਂ ਗਾਵਾਂ ਰੱਖ ਕੇ ਅਤੇ ਪਾਣੀ ਨਦੀ ਦੇ ਵਿੱਚੋਂ ਮਛਲੀਆਂ ਕੱਢ ਕੇ ਖਾਣਾ ਵੀ ਪਸੰਦ ਕਰੂਗੀ ਜੇ ਮੈਨੂੰ ਕਦੀ ਮੌਕਾ ਮਿਲੇ ਉੱਥੇ ਨਾਲ ਆਪਣੇ ਕਿਸੇ ਨੂੰ ਲੈ ਕੇ ਜਾਣ ਦਾ ਤਾਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਊਂਗੀ ਅਤੇ ਉੱਥੇ ਜਾ ਕੇ ਸਵੇਰ ਦੀ ਸੈਰ ਵਗੈਰਾ ਆਲੇ ਦੁਆਲੇ ਘੁੰਮਣਾ ਫਿਰਨਾ ਸ ਸਾਰਾ ਕਰਾਂਗੇ ਅਤੇ ਇੰਨੀ ਸਾਫ ਸਫਾਈ ਦੀ ਵਧੀਆ ਜਗ੍ਹਾ 'ਤੇ ਯਾਨੀ ਕਿ ਲਾਈਫ ਥੋੜ੍ਹੀ ਜਿਹੀ ਆਪਣੀ ਤੰਦਰੁਸਤ ਹੋ ਜਾਂਦੀ ਆ ਦਵਾਈਆਂ ਤੋਂ ਖਹਿੜਾ ਛੁੱਟ ਜਾਊਗਾ ਲਾਈਫ ਵੀਹ ਸਾਲ ਹੋਰ ਵਧੀਆ ਹੋ ਜਾਊਗੀ